ਹਾਂਜੀ ਹਾਂਜੀ ਨਮਸਕਾਰ ਜੀ ਬਸ ਠੀਕ ਹੈ ਜੀ ਤੁਸੀਂ ਸੁਣਾਓ ਹਾਂਜੀ ਹਾਂਜੀ ਹੋਰ ਠੀਕ ਹੈਗਾ ਜੀ ਤੁਸੀਂ ਸੁਣਾਓ ਤੁਹਾਡਾ ਕੰਮ ਕਾਰ ਕਿਸ ਤਰਾਂ ਚੱਲ ਰਿਹਾ ਹਾਂਜੀ ਹਾਂਜੀ ਹਾਂਜੀ ਲਾਈਵ ਏ ਬਹੁਤ ਹੋ ਗਈ ਹੈ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਰੀ ਸਟੇਸ਼ ਸਟੇਸ਼ਨਰੀ ਪੂਰੀ ਰੱਖੀ ਵੀ ਹੈ ਜੀ ਕਾਪੀਆਂ ਰੱਖੀ ਵੀ ਹੈ ਪਰ ਪਹਿਲੇ ਵਰਗੀ ਕਮਾਈ ਹੈ ਨਹੀਂ ਜੀ ਇਹ ਹੈ ਵੀ ਹਾਂਜੀ ਹਾਂਜੀ ਅ ਹਾਂ ਹਾਂਜੀ ਹਾਂਜੀ ਹੋਰ ਸੁਣਾਓ ਜੀ ਹੋਰ ਸਭ ਸਭ ਠੀਕ ਹੈ ਜੀ ਸਾਸੀ